ਜੀ ਅਸੀਂ ਫਰਨੀਚਰ ਵਾਲੇ ਬੋਲਦੇ ਹਾਂ

ਅੱਛਾ ਜੀ ਬਣਾ ਦਾਂਗੇ ਕਿਹੋ ਜਿਹਾ ਬਣਵਾਉਣਾ ਹਾਂਜੀ ਬਣਾ ਦਾਂਗੇ ਜੀ ਜੀ ਹਾਂਜੀ ਬਣਾ ਦੇਣਗੇ ਜੀ ਅਸੀਂ ਚੀਲ ਜੀ ਚੀਲ ਦੀ ਲਾ ਦੇਣੇ ਹਾਂਜੀ ਪਲਾਈ ਪਲੁਈ ਵਧੀਆ ਲਾ ਦਿੰਦੇ ਹਾਂ ਜੀ ਹਾਂਜੀ ਬਣਾ ਦੇ ਜੀ ਸਾਰਾ ਕੁਛ ਬਣਾ ਦਿੰਦੇ

ਜੀ ਜਿਹੜਾ ਤੁਸੀਂ ਜਿਹੜਾ ਤੁਸੀਂ ਕਹੋਂਗੇ ਉਹੀ ਬਣਾ ਦਾਂਗੇ ਡਿਜ਼ਾਇਨ ਤੁਸੀਂ ਸਾਨੂੰ ਦੱਸ ਦਿਓ ਨਾ ਦੁਕਾਨ 'ਤੇ ਆ ਜਿਓ ਜੀ ਪਹਿਲਾਂ ਤੁਸੀਂ ਦੱਸੋ ਜੀ ਕਿਹੋ ਜਿਹਾ ਬਣਾਉਣਾ ਜੀ ਫਿਰ ਫਿਰ ਪਤਾ ਲੱਗੂਗਾ ਵੀ ਦੇਖ ਕੇ ਪਤਾ ਲੱਗੂ ਵੀ ਕਿੰਨਾ ਰੇਟ ਲੱਗੂਗਾ ਜੀ ਫੜ੍ਹਾ ਜਿਓ ਹਾਂਜੀ ਬਣਾ ਦਿੰਦੇ ਹਾਂ ਕੁਰਸੀਆਂ ਵੀ ਜੀ ਡਿਜ਼ਾਈਨ ਵਾਲੀਆਂ ਕੁਰਸੀਆਂ ਹਾਂਜੀ ਕੁਰਸੀਆਂ ਦੇ ਜੀ ਲਾ ਦਿੰਦੇ ਹਾਂ ਜੀ ਪੰਦਰਾਂ ਸੌ ਜੀ ਦੋ ਹਜ਼ਾਰ ਪੱਚੀ ਸੌ ਇੰਨਾ ਰੇਟ ਹੋ ਜਾਂਦਾ ਬਾਕੀ ਕੁਰਸੀਆਂ ਜਿਵੇਂ ਜੀ ਸੈੱਟ ਦਾ ਤਾਂ ਅਸੀਂ ਲਾਉਨ ਸੈੱਟ ਦਾ ਅਸੀਂ ਲਾਉਂਦੇ ਹਾਂ ਪੰਜ ਹਜ਼ਾਰ ਜੀ ਵਧੀਆ ਲੱਗੂਗੀ ਵਧੀਆ ਜੀ ਉਲਾਂਭਾ ਨਹੀਂ ਆਉਂਦਾ ਤੁਹਾਨੂੰ ਜੀ ਜੀ ਕੋਈ ਨਹੀਂ ਜੀ ਹਾਂਜੀ ਬਣਾ ਦਿੰਦੇ ਹਾਂ ਜੀ ਜੀ ਇੱਥੇ ਜੀ ਬਠਿੰਡਾ ਰੋਡ ਬਾਈਪਾਸ 'ਤੇ ਜੀ ਆ ਜਿਓ ਜੀ ਸੇ ਆ ਜਿਓ ਜੀ ਸਵੇਰੇ ਜਾਂ ਪਰਸੋਂ ਆ ਜਿਓ ਜਦੋਂ ਤੁਹਾਨੂੰ ਟਾਈਮ ਲੱਗੇ ਜੀ ਅਸੀਂ ਆ ਜਾਂਦੇ ਹਾਂ ਅੱਠ ਨੌਂ ਵਜੇ ਤਾਂ ਆ ਜਾਂਦੇ ਹਾਂ ਹਾਂਜੀ ਕੋਈ ਨਾ ਜੀ ਜੀ ਆ ਜਿਓ ਆ ਜਿਓ ਆ ਜਿਓ ਭੇਜ ਦਾਂਗੇ ਨੰਬਰ ਜੀ ਠੀਕ